ਸਤਿ ਸ਼੍ਰੀ ਅਕਾਲ ਜੀ ਮੈਂ ਬਲਵੰਤ ਰਾਜ ਮੈਂ ਔਨਲਾਇਨ ਐਡੀਡਾਸ ਦੇ ਦੋ ਜੋੜੀਆਂ ਸ਼ੂਜ ਬੁੱਕ ਕਰਵਾਏ ਸੀਗੇ ਅਤੇ ਕੋਪਨੀ ਨੇ ਮੈਨੂੰ ਜਿਹੜੀ ਡਲੀਵਰੀ ਡੇਟ ਦਿੱਤੀ ਸੀਗੀ ਉਸ ਤੋਂ ਇੱਕ ਦਿਨ ਪਹਿਲਾਂ ਹੀ ਮੈਨੂੰ ਉਹ ਦੋ ਜੋੜੀਆਂ ਸ਼ੂਜ ਮਿਲ ਗਏ ਸੀ ਸ਼ੂਜ ਚੰਗੀ ਕੁਆਲਟੀ ਦੇ ਸੀ ਅਤੇ ਮੈਂ ਉਹ ਇੱਕ ਸ਼ੂਜ ਦਾ ਜੋੜਾ ਆਪਣੇ ਲਈ ਅਤੇ ਇੱਕ ਆਪਣੇ ਬੱਚੇ ਲਈ ਮੰਗਵਾਇਆ ਸੀ ਹੁਣ ਉਹ ਦੋਵੇਂ ਸ਼ੂਜ ਅਸੀਂ ਬੜੇ ਸਹੀ ਤਰੀਕੇ ਨਾਲ ਵਰਤ ਰਹੇ ਹਾਂ ਅਤੇ ਸਾਨੂੰ ਬੜੇ ਉਹਦੇ ਨਾਲ ਰਿਲੈਕਸ ਵੀ ਮਹਿਸੂਸ ਹੁੰਦਾ ਹੈ ਸਵੇਰੇ ਉੱਠ ਕੇ ਸਵੇਰੇ ਸ਼ਾਮ ਉਹਦੇ ਨਾਲ ਬੜੇ ਪਿਆਰ ਨਾਲ ਬਾਕਿੰਗ ਵੀ ਕਰੀਦੀ ਹੈ ਅਤੇ ਦੌੜ ਵੀ ਲਾਈਦੀ ਹੈ ਉਹਦੇ ਨਾਲ ਸਾਨੂੰ ਸਰੀਰਿਕ ਅਤੇ ਮਾਨਸਿਕ ਫੀਲਿੰਗ ਬੜੀ ਅੱਛੀ ਫੀਲਿੰਗ ਆਉਂਦੀ ਹੈ ਅਤੇ ਨਾਲ ਸਾਡਾ ਸਰੀਰ ਵੀ ਬਿਲਕੁਲ ਉਹਦੇ ਨਾਲ ਫਿੱਟ ਰਹਿੰਦਾ ਹੈ ਉਹਦੇ ਲੇਸ ਵੀ ਬੜੇ ਵਧੀਆ ਨੇ ਉਹਦੇ ਮਤਲਬ ਪੈਰਾਂ ਦੇ ਉਹ ਪੈਰ ਗਰਿਪ ਜਿਹੜੀ ਹੈ ਬਹੁਤ ਵਧੀਆ ਮਤਲਬ ਬਹੁਤ ਹੀ ਮੈਂ ਕਹਿੰਦਾ ਬਈ ਬਹੁਤ ਹੀ ਵਧੀਆ ਸ਼ੂਜ ਨੇ ਅਤੇ ਅਸੀਂ ਪੈਸੇ ਦੇ ਮਾਮਲੇ 'ਚ ਵੀ ਥੋੜ੍ਹੇ ਠੀਕ ਹੀ ਹੈ ਪੈਸਾ ਵੀ ਚਲੋ ਪੈਸਾ ਖਰਚ ਕੇ ਚੰਗੀ ਚੀਜ਼ ਮਿਲਜੇ ਨਾ ਅਤੇ ਉਹਦਾ ਇਹ ਹੁੰਦਾ ਹੈ ਵ ਗ ਗਾਹਕ ਨੂੰ ਮਹਿਸੂਸ ਨਹੀਂ ਹੁੰਦਾ ਅਤੇ ਇਸ ਲਈ ਮੈਂ ਚਾਹੁੰਦਾ ਬਈ ਇਸ ਇਸ ਤੋਂ ਬਾਅਦ ਮੈਂ ਹੋਰ ਵੀ ਲੋਕਾਂ ਨੂੰ ਕਹਿੰਦਾ ਬਈ ਇਸ ਨਾਲ ਦੇ ਹੀ ਸ਼ੂਜ ਮੰਗਾਉਣ ਅਤੇ ਤਾਂ ਜੋ ਉਹ ਸਾਡੇ ਸਰੀਰ ਨੂੰ ਅਤੇ ਪੈਰਾਂ ਨੂੰ ਬਿਲਕੁਲ ਐਨ ਫਿੱਟ ਰੱਖਣ ਬੰਦੇ ਨੂੰ ਮਤਲਬ ਬਿਲਕੁਲ ਸਹੀ ਫਿੱਟ ਰੱਖਣ ਧੰਨਵਾਦ ਜੀ